ਭੰਗੜਾ ਐਰੋਬਿਕਸ ਬਾਰੇ ਲੋਕਾਂ ਸਭ ਤੋਂ ਵੱਡੀਆਂ ਗਲਤ ਧਾਰਨਾਵਾਂ ਵਿੱਚੋਂ ਇੱਕ ਇਹ ਹੈ ਕਿ ਇਹ ਸਿਰਫ ਨੱਚਣ ਵਾਲਿਆਂ ਲਈ ਹੈ ਜਾਂ ਸਿਰਫ ਜਮੀਨ ਤੇ ਸਹੀ ਕਰਨਾ ਜਰੂਰੀ ਹੈ ਇਸ ਨੂੰ ਅਕਸਰ ਇਕ ਖਾਸ ਖੇਤਰ ਜਾਂ ਸੱਭਿਆਚਾਰ ਨਾਲ ਜੋੜਿਆ ਜਾਂਦਾ ਜਿੱਥੇ ਇਹ ਸੋਚਿਆ ਜਾਂਦਾ ਹੈ ਕੀ ਇਸਦਾ ਸਾਰਾ ਫਾਇਦਾ ਉਹਨਾਂ ਲੋਕਾਂ ਲਈ ਹੈ ਜੋ ਭੰਗੜਾ ਜਾ ਧੁਨੀਆਂ ਨਾਲ ਮਾਨਦੇ ਹਨ ਹਕੀਕਤ ਵਿੱਚ ਭੰਗੜਾ ਐਰੋਬਿਕਸ ਸਿੱਖ ਬਿਆਨ ਦਾ ਰੂਪ ਹੈ ਜੋ ਸਾਰੇ ਜਨਰਲ ਫਿਟਨੈਸ ਲੈ ਬਣਾ ਤੇ ਸਾਰੇ ਵਿਅਕਤੀਆਂ ਲਈ ਉਪਯੋਗੀ ਹੈ ਦੂਜੀ ਗਲਤਫਹਿਮੀ ਇਹ ਹੈ ਕੀ ਭੰਗੜਾ ਐਰੋਬਿਕਸ ਸਿਰਫ ਖੇਡਾਂ ਜਾਂ ਡਾਂਸ ਮਜੂਜਮਾ ਦੇ ਨਾਲ ਹੀ ਮਿਲਦਾ ਹੈ ਇਸ ਨੂੰ ਇੱਕ ਸੰਪੂਰਨ ਕਸਰਤ ਦੀ ਤਰ੍ਹਾਂ ਨਹੀਂ ਦੇਖਿਆ ਜਾਂਦਾ ਭੰਗੜਾ ਐਰੋਬਿਕਸ ਦੇ ਸਹੀ ਤਰੀਕੇ ਅਤੇ ਢੰਗ ਨਾਲ ਕਰਨ ਨਾਲ ਇਹ ਸੰਪੂਰਨ ਪੂਰੀ ਦੇਹ ਦੀ ਬਿਆਨ ਦੀ ਇੱਕ ਖਾਸ ਸ਼ੈਲੀ ਹੈ ਬਣ ਜਾਂਦੀ ਹੈ ਜੋ ਹਰ ਕਿਸੇ ਦੀ ਸਿਹਤ ਅਤੇ ਤੰਦਰੁਸਤੀ ਵਿਚ ਸੁਧਾਰ ਲਿਆਉਂਦੀ ਹੈ ਤੀਜੀ ਗਲਤਫਹਿਮੀ ਇਹ ਹੈ ਕੀ ਭੰਗੜਾ ਐਰੋਬਿਕਸ ਹਮੇਸ਼ਾ ਇੱਕ ਜਮੀਨ ਤੇ ਕਰਨ ਵਾਲੀ ਐਕਸਰਸਾਈਜ਼ ਹੈ ਇਹਦੀ ਖੁਸ਼ੀ ਵਾਲੀ ਕੁਆਲਿਟੀ ਨਹੀਂ ਹੈ ਇਹ ਗਲਤ ਧਾਰਨਾਵਾਂ ਨੂੰ ਹੱਲ ਕਰਨ ਲਈ ਮੈਂ ਲੋਕਾਂ ਨੂੰ ਸਹੀ ਜਾਣਕਾਰੀ ਮੁਹੱਈਆ ਕਰਾਵਾਂਗਾ ਅਤੇ ਵਿਅਕਤੀਆਂ ਨੂੰ ਇਹ ਦਿਖਾਵਾਂਗਾ ਕੀ ਭੰਗੜਾ ਐਰੋਬਿਕਸ ਸਾਰੇ ਜੀਵਨ ਅੰਗਾ ਲਈ ਲਾਭਦਾਇਕ ਹੈ ਇਹ ਇੱਕ ਸਰੀਰ ਦੇ ਅੰਗ ਨੂੰ ਨਾ ਪ੍ਰਭਾਵਿਤ ਕਰਕੇ ਸਰੀਰ ਦੇ ਸਾਰੇ ਅੰਗਾਂ ਤੇ ਹੀ ਪ੍ਰਭਾਵ ਪਾਉਂਦਾ ਹੈ ਸਾਰੇ ਸਰੀਰ ਨੂੰ ਹੀ ਤਕੜਾ ਅਤੇ ਤੰਦਰੁਸਤ ਬਣਾਉਂਦਾ ਹੈ ਇੱਕ ਸਿਹਤਮੰਦ ਜੀਵਨ ਨੂੰ ਪ੍ਰਚਾਰਤ ਕਰਨ ਲਈ ਇੱਕ ਖੇਡ ਦੇ ਤੌਰ 'ਤੇ ਨੀ ਬਲਕਿ ਇੱਕ ਬਿਆਮ ਇੱਕ ਕਸਰਤ ਸਰਗਰਮੀ ਦੇ ਤੌਰ ਤੇ ਭੰਗੜਾ ਐਰੋਬਿਕਸ ਨੂੰ ਦੇਖਿਆ ਜਾਂਦਾ ਹੈ